ਅਸੀਂ ਆਪਣੇ ਘਰ ਨੂੰ ਪਾਣੀ ਝਾੜੂ ਅਤੇ ਪੋਚੇ ਦੀ ਮਦਦ ਨਾਲ ਧੋਂਦੇ ਹਾਂ ਪਹਿਲਾਂ ਸਾਰੇ ਘਰ ਵਿੱਚ ਅਸੀਂ ਝਾੜੂ ਨਾਲ ਕੂੜਾ ਇਕੱਠਾ ਕਰਦੇ ਹਾਂ ਅਤੇ ਉਸ ਨੂੰ ਫਿਰ ਬਾਹਰ ਰੱਖੇ ਹੋਏ ਅਲੱਗ ਅਲੱਗ ਗਿੱਲੇ ਅਤੇ ਸੁੱਕੇ ਕੂੜੇ ਲਈ ਡਸਟਵੀਨਾਂ ਵਿੱਚ ਪਾਇਆ ਜਾਂਦਾ ਹੈ ਜਿਹੜਾ ਫਰਸ਼ ਪੱਕਾ ਹੈ ਉਸ ਨੂੰ ਪਾਣੀ ਨਾਲ ਧੋਂਦੇ ਹਾਂ ਅਸੀਂ ਆਪਣੇ ਘਰ ਦਾ ਕੁਝ ਹਿੱਸਾ ਕੱਚਾ ਛੱਡਿਆ ਹੋਇਆ ਹੈ ਜਿੱਥੇ ਅਸੀਂ ਗਊ ਡੰਕ ਦੀ ਵਰਤੋਂ ਕਰਦੇ ਹਾਂ ਗਊ ਡੰਕ ਨਾਲ ਲਿਪਿਆ ਹੋਇਆ ਫਰਸ਼ ਸਾਡੇ ਲਈ ਬਹੁਤ ਹੀ ਗੁਣਕਾਰੀ ਹੈ ਗਊ ਡੰਕ ਵਿੱਚ ਸਾਡੀ ਸਿਹਤ ਲਈ ਬਹੁਤ ਸਾਰੇ ਗੁਣਕਾਰੀ ਤੱਤ ਮੌਜੂਦ ਹੁੰਦੇ ਹਨ ਇਸ ਨਾਲ ਘਰ ਦਾ ਤਾਪਮਾਨ ਠੰਡਾ ਰਹਿੰਦਾ ਹੈ ਬੱਚੇ ਨੰਗੇ ਪੈਰਾਂ ਇਸ ਗਊ ਡੰਕ ਨਾਲ ਲਿੱਪੇ ਫਰਸ਼ 'ਤੇ ਖੇਡ ਸਕਦੇ ਹਨ ਗਊ ਡੰਕ ਨਾਲ ਲਿਪੇ ਫਰਸ਼ ਦੇ ਸਾਡੇ ਸਿਹਤ 'ਤੇ ਬਹੁਤ ਚੰਗੇ ਪ੍ਰਭਾਵ ਪੈਂਦੇ ਹਨ